ਮੈਂ ਆਪਣੇ ਪਾਪਾ ਦੇ ਕੋਲ ਦਿੱਲੀ ਜਾਣਾ ਪਸੰਦ ਕਰੂੰਗਾ ਕਿਉਂਕਿ ਮੇਰੇ ਪਾਪਾ ਦਿੱਲੀ ਰਹਿੰਦੇ ਹਨ ਅਤੇ ਉੱਥੇ ਜਾ ਕੇ ਮੈਨੂੰ ਬਹੁਤ ਹੀ ਵਧੀਆ ਮਹਿਸੂਸ ਹੁੰਦਾ ਹੈ ਅਤੇ ਮੈਨੂੰ ਬਹੁਤ ਸਾਰੀਆਂ ਚੀਜ਼ਾਂ ਦਾ ਪਤਾ ਲੱਗਦਾ ਹੈ ਕਿ ਵੱਡੇ ਸ਼ਹਿਰਾਂ ਦੇ ਵਿੱਚ ਜਾ ਕੇ ਕਿਵੇਂ ਰਹਿਣਾ ਸਹਿਣਾ ਹੈਗਾ ਅਤੇ ਉੱਥੇ ਲੋਕ ਕੰਮ ਕਿੱਦਾਂ ਕਰਦੇ ਹਨ ਅਤੇ ਉੱਥੇ ਲੋਕ ਇੱਕ ਦੂਜੇ ਨਾਲ ਗੱਲਬਾਤ ਕਿਵੇਂ ਕਰਦੇ ਹਨ ਅਤੇ ਲੋਕ ਉੱਥੇ ਕੀ ਕੀ ਖਾਂਦੇ ਹਨ ਜਾਂ ਕੀ ਕੀ ਪਾਉਂਦੇ ਹਨ ਕਿ ਕੀ ਕਿਵੇਂ ਕਿਵੇਂ ਪਾਉਂਦੇ ਹਨ ਕਿੱਦਾਂ ਉੱਥੇ ਰਹਿੰਦੇ ਹਨ ਅਤੇ ਕਿੱਦਾਂ ਉੱਥੇ ਕੀ ਮਤਲਬ ਆਪਣੇ ਕੰਮਾਂ ਕਾਰਾਂ 'ਤੇ ਕਿਵੇਂ ਜਾਂਦੇ ਹਨ ਅਤੇ ਫਿਰ ਉਹਦੇ ਬਾਅਦ ਦਿੱਲੀ ਇੱਕ ਇੱਦਾਂ ਦਾ ਸ਼ਹਿਰ ਹੈ ਕਿ ਜਿਹੜਾ ਬਹੁਤ ਜ਼ਿਆਦਾ ਬੀਜੀ ਸ਼ਹਿਰ ਰਹਿੰਦਾ ਅਤੇ ਉੱਥੇ ਟਰੈਫਿਕ ਬਹੁਤ ਜ਼ਿਆਦਾ ਹੀ ਹੁੰਦਾ ਸਾਰਾ ਸਾ ਸਾਨੂੰ ਸਾਰਿਆਂ ਨੂੰ ਪਤਾ ਅਤੇ ਫਿਰ ਉਹਦੇ ਬਾਅਦ ਆਪਣਾ ਕਿ ਮੈਨੂੰ ਜਦੋਂ ਮੈਂ ਆਪਣੇ ਪਾਪਾ ਕੋਲ ਜਾਂਦਾ ਤਾਂ ਉੱਥੇ ਜਾ ਕੇ ਮੈਨੂੰ ਮਤਲਬ ਬਹੁਤ ਵਧੀਆ ਲੱਗਦਾ ਅਤੇ ਮੈਂ ਉੱਥੇ ਸ਼ੁਰੂ ਤੋਂ ਰਹਿੰਦਾ ਆ ਦਾ ਹਾਂ